ਸਤਿ ਸ੍ਰੀ ਅਕਾਲ ਮੈਂ ਹਾਲ ਵਿੱਚ ਹੀ ਇੱਕ ਮੈਡੀਕਲ ਟੈਸਟ ਕਰਵਾਇਆ ਹੈ ਕਿ ਤੁਸੀਂ ਦੱਸ ਸਕਦੇ ਹੋ ਮੇਰੇ

ਬੀਮੇ ਦੀ ਕੀ ਸਥਿਤੀ ਹੈ ਮੇਰੀ ਕਲੇਮ ਆਈਡੀ ਆਰ ਕੇ ਜੀਰੋ ਪੰਜ ਛੇ ਸੱਤ ਅੱਠ ਨੌ ਹੈ